ਮੈਂ ਜ਼ਿਆਦਾਤਰ ਦੇਖਿਆ ਵਾ ਕਿ ਲੋਕ ਜਿੱਥੇ ਸੈਰ ਸਪਾਟਾ ਕਰਨ ਜਾਂਦੇ ਹੈਗੇ ਆ ਉੱਥੇ ਹੀ ਕਚਰਾ ਵਗੈਰਾ ਜਿਵੇਂ ਖਾ ਪੀ ਕੇ ਪੈਕਟ ਵਗੈਰਾ ਹੈਗੇ ਆ ਉੱਥੇ ਹੀ ਸੁੱਟ ਦਿੰਦੇ ਹੈਗੇ ਆ ਅਤੇ ਬਹੁਤ ਜ਼ਿਆਦਾ ਕਈ ਸਮੋਕ ਵਗੈਰਾ ਕਰ ਲੈਂਦੇ ਹੈਗੇ ਜਿੱਥੇ ਸੈਰ ਸਪਾਟਾ ਕਰਨ ਜਾਂਦੇ ਉੱਥੇ ਸਮੋਕਿੰਗ ਕਰਨ ਜਾਣਗੇ ਜਦੋਂ ਕਿ ਉੱਥੇ ਲਿਖਿਆ ਵੀ ਹੋਏਗਾ ਕਿ ਸਮੋਕਿੰਗ ਇਜ਼ ਨੋਟ ਅਲਾਊਡ ਬਟ ਤਾਂ ਵੀ ਜਿਹੜੇ ਲੋਕ ਹੈਗੇ ਆ ਧਿਆਨ ਹੀ ਨਹੀਂ ਦਿੰਦੇ ਅਤੇ ਜਿਵੇਂ ਕਿ ਮੈਂ ਆਪਣੇ ਘਰ ਦੇ ਨੇੜੇ ਚਲ ਜਾਂਦੀ ਹੁੰਦੀ ਹਾਂ ਸੈਰ ਸਪਾਟਾ ਕਰਨ ਪਾਰਕ ਵਗੈਰਾ 'ਚ ਅਤੇ ਉੱਥੇ ਦੇਖਦੀ ਹਾਂ ਕਿ ਜਿਹੜੇ ਉੱਥੇ ਬਗੀਚਾ ਬਣਿਆ ਹੈਗਾ ਪਾਰਕ ਦੇ ਵਿੱਚ ਜਿਹੜੇ ਫਲਾਵਰਸ ਵਗੈਰਾ ਹੈਗੇ ਆ ਤੇ ਉਹ ਵੀ ਬਿਲਕੁਲ ਹੀ ਮੁਰਝਾਏ ਹੁੰਦੇ ਆ ਕੋਈ ਉੱਥੇ ਪਾਣੀ ਵਗੈਰਾ ਨਹੀਂ ਪਾਉਂਦੇ ਹੈਗੇ ਜਿਹੜਾ ਗਾਰਡਨਰ ਹੈਗਾ ਆਪਣੀ ਡਿਊਟੀ ਨਹੀਂ ਨਿਭਾਉਂਦਾ ਹੈਗਾ ਅਤੇ ਨਾ ਹੀ ਉੱਥੇ ਕੋਈ ਗਾਰਡ ਵਗੈਰਾ ਹੈਗਾ ਵਾ ਕਿ ਹਾਂ ਵੀ ਉੱਥੇ ਜਿਹੜੇ ਡੋਗਸ ਵਗੈਰਾ ਹੈਗੇ ਆ ਉਹ ਵੀ ਸਿੱਧਾ ਅੰਦਰ ਆ ਜਾਂਦੇ ਹੈਗੇ ਅਤੇ ਗੰਦ ਵਗੈਰਾ ਪਾ ਦਿੰਦੇ ਹੈਗੇ ਆ ਜਿਹੜੇ ਝੂਲੇ ਆ ਉਹ ਵੀ ਉੱਥੇ ਕੋਈ ਸੈੱਟ ਵਗੈਰਾ ਨਹੀਂ ਹੈਗੇ ਕਈ ਟੁੱਟੇ ਹੈਗੇ ਆ ਝੂਲੇ ਅਤੇ ਮੈਂ ਇਹ ਹੀ ਸਰਕਾਰ ਨੂੰ ਜਾਂ ਕਮਜ਼ ਰਿਕੁਐਸਟ ਕਰਨਾ ਚਾਹੂੰਗੀ ਕਿ ਉੱਥੇ ਆਣ ਕੇ ਮੀਨਸ ਦੇਖਣ ਕਿ ਹਾਂ ਵੀ ਕਿ ਜਿਵੇਂ ਪਾਰਕਸ ਵਗੈਰਾ ਹੈਗੇ ਆ ਉੱਥੇ ਕਿੰਨਾ ਹੀ ਜ਼ਿਆਦਾ ਕਚਰਾ ਵਾ ਮੇਰੀ ਇਹੀ ਰਿਕੁਐਸਟ ਆ ਕਿ ਹਾਂ ਉਹ ਗਾਰਡਨਰ ਦੇਖਣ ਕਿ ਹਾਂ ਉਸ ਗਾਰਡਨਰ ਦਾ ਦੇਖਣ ਕਿ ਉਹ ਜਿਹੜਾ ਗਾਰਡਨਰ ਹੈਗਾ ਕਿਉਂ ਨਹੀਂ ਆ ਰਿਹਾ ਆਪਣੇ ਟਾਈਮ ਦੇ ਉੱਤੇ ਕਿਉਂ ਉੱਥੇ ਕੋਈ ਗਾਰਡ ਅਵੇਲੇਬਲ ਨਹੀਂ ਹੈਗਾ ਕਿਉਂ ਉੱਥੇ ਜਿਹੜਾ ਮਰਜ਼ੀ ਆ ਸਕਦਾ ਹੈਗਾ ਹੈਗਾ ਕਿਉਂ ਉੱਥੇ ਕੋਈ ਲੋਕ ਆ ਕੇ ਆਪੇ ਹੀ ਬਰੇਕ ਕਰ ਜਾਂਦੇ ਹੈਗੇ ਝੂਲੇ ਵਗੈਰਾ ਹੈਗੇ ਆ ਜਾਂ ਉੱਥੇ ਡਸਟਬਿਨਸ ਜਿਹੜੇ ਹੈਗੇ ਆ ਉਹ ਤੋੜ ਜਾਂਦੇ ਹੈਗੇ ਆ ਅਤੇ ਇੰਨਾ ਜ਼ਿਆਦਾ ਕਚਰਾ ਪਾਏਗਾ ਕੋਈ ਹਿਸਾਬ ਨਹੀਂ ਅਤੇ ਜੇ ਸੈਰ ਸਪਾਟੇ ਦੀ ਥਾਂ 'ਤੇ ਜਿਵੇਂ ਕਿਤੇ ਹੋਰ ਵੀ ਜਾਂਦੀ ਹੈਗੀ ਆ ਉੱਥੇ ਵੀ ਅਲਾਊਡ ਨਹੀਂ ਹੈਗਾ ਕਿ ਹਾਂ ਵੀ ਗਾਰਡ ਕੋਈ ਬੈਠਾ ਹੋਵੇ ਕੋਈ ਦੇਖੇ ਕਿ ਕਿਉਂ ਇਸ ਤਰ੍ਹਾਂ ਕੋਈ ਕਚਰਾ ਫੇਂਕ ਰਿਹਾ ਹੈਗਾ ਉਸੇ ਟਾਈਮ 'ਤੇ ਉਹਨੂੰ ਜਿਹੜਾ ਫਾਈਨ ਵਗੈਰਾ ਪਾ ਦੇ ਕਿ ਹਾਂ ਬਾਈ ਕਿਉਂ ਇਹ ਗੰਦ ਸੁੱਟਿਆ ਹੈਗਾ ਵਾ ਕਿਉਂ ਕਚਰਾ ਸੁੱਟਿਆ ਹੈਗਾ ਵਾ ਅਤੇ ਇਸ ਚੀਜ਼ ਦਾ ਫਾਈਨ ਪਊਗਾ ਉੱਥੇ ਜੇ ਉਹਨਾਂ ਨੂੰ ਫਾਈਨ ਵਗੈਰਾ ਦੱਸ ਲਿਖ ਦੇਣ ਕਿ ਹਾਂ ਵੀ ਜੇ ਕਿਸੇ ਨੇ ਕਚਰਾ ਸੁੱਟਿਆ ਤਾਂ ਉੱਥੇ ਇੰਨਾ ਫਾਈਨ ਪਊਗਾ ਜੇ ਕਿਸੇ ਚ ਨੇ ਸਮੋਕ ਵਗੈਰਾ ਕੀਤੀ ਤਾਂ ਉੱਥੇ ਇੰਨਾ ਜਿਹੜਾ ਫਾਈਨ ਪੈ ਜੂਗਾ ਅਤੇ ਮੇਰੀ ਇਹ ਹੀ ਸਿਫਾਰਿਸ਼ ਹੈਗੀ ਆ ਕਿ ਸਰਕਾਰ ਜਿਹੜੀ ਚੀਜ਼ ਆ ਇਸ ਗੱਲ ਵੱਲ ਧਿਆਨ ਦੇਵੇ ਕਿ ਜਿਹੜੀਆਂ ਪਾਰਕਸ ਹੋ ਗਈਆਂ ਜਾਂ ਕੋਈ ਵੀ ਆਪਾਂ ਸੈਰ ਸਪਾਟੇ ਥਾਂ ਹੁੰਦੀ ਹੈ ਕਿਉਂਕਿ ਬਾਹਰੋਂ ਲੋਕ ਵੀ ਕਈ ਵੇਖਣ ਲਈ ਆਉਂਦੇ ਹੈਗੇ ਆ 'ਤੇ ਜਿਹੜਾ ਆਪਣਾ ਬੈਡ ਇੰਪਰੈਸ਼ਨ ਨਾ ਪਵੇ ਗੁੱਡ ਇੰਪਰੈਸ਼ਨ ਪਵੇ ਕਿ ਕਿਵੇਂ ਇੱਕ ਸੁਸਾਇਟੀ ਨੇ ਕਿਵੇਂ ਇੱਕ ਕੰਟਰੀ ਨੇ ਆਪਣੀ ਜਿਹੜੀ ਚੀਜ਼ਾਂ ਹੈਗੀਆਂ ਉਹ ਸਾਫ਼ ਸੁਥਰੀਆਂ ਰੱਖੀਆਂ ਹੈਗੀਆਂ ਵਾ ਇੰਪਰੈਸ਼ਨ ਇੱਕ ਬਹੁਤ ਵੱਡੀ ਚੀਜ਼ ਇੱਕ ਬਣ ਜਾਂਦੀ ਹੈਗੀ ਆ